ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਦੂਜਿਆਂ ਨਾਲ ਗੱਲਬਾਤ ਕਰਨ ਲਈ ਸੌਖੇ ਤਰੀਕੇ ਨਾਲ ਇੱਦਾਂ ਕਰਦੇ ਨੇ ਵੀ ਜਦੋਂ ਬ ਸਮਝਣ ਵਾਲਾ ਬੰਦਾ ਅੱਗੇ ਪੰਜਾਬੀ ਨਾ ਹੋਵੇ ਹਿੰਦੀ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਸਮਝਦਾ ਤਾਂ ਪੰਜਾਬੀ ਬੰਦੇ ਨੂੰ ਆਪਣੀ ਭਾਸ਼ਾ ਬਦਲਣੀ ਪੈਂਦੀ ਆ ਉਹ ਉਹਦੇ ਨਾਲ ਹਿੰਦੀ 'ਚ ਗੱਲ ਕਰੇਗਾ ਜਾਂ ਫਿਰ ਇੰਗਲਿਸ਼ 'ਚ ਕਰੇਗਾ ਜਿੱਦਾਂ ਹੁਣ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਵੀ ਤੁਸੀਂ ਕੀ ਕਰਦੇ ਹੋ ਹਿੰਦੀ 'ਚ ਜੋ ਗੱਲ ਸਮਝ ਦਾ ਨਹੀਂ ਤਾਂ ਹਿੰਦੀ 'ਚ ਉਹਦੇ ਨਾਲ ਗੱਲ ਕਰਨੀ ਪੈਂਦੀ ਆ ਆਪ ਕਿਆ ਕਰ ਰਹੇ ਹੋ ਇੱਦਾਂ ਜਾਣੀ ਆਪਣੇ ਬਰਡ ਨੇ ਜੋ ਚੇਂਜ ਕੀਤੇ ਜਾਂਦੇ ਨੇ ਬਦਲੇ ਜਾਂਦੇ ਨੇ ਆਪਣੀ ਭਾਸ਼ਾ ਵੀ ਬਦਲੀ ਜਾਂਦੀ ਹੈ ਆਪਣੀ ਭਾਸ਼ਾ ਦੇ ਬਦਲਣ ਨਾਲ ਦੂਜੇ ਨੂੰ ਸੌਖੇ ਤਰੀਕੇ ਨਾਲ ਸਮਝਿਆ ਅਤੇ ਸਮਝਾਇਆ ਜਾ ਸਕਦਾ